ਸਤਿ ਸ਼੍ਰੀ ਅਕਾਲ ਜੀ ਮੈਂ ਕਾਰਤਿਕ ਬੋਲ ਰਿਹਾ ਪਠਾਨਕੋਟ ਤੋਂ ਮੈਂ ਪਠਾਨਕੋਟ ਦਾ ਨਿਵਾਸੀ ਹਾਂ ਔਰ ਸਾਡੇ ਟੈਕਨੋਲਜੀ ਕਾਰਨ ਮਨੋਰੰਜਨ ਵਿੱਚ ਕਾਫੀ ਕਾਫੀ ਜ਼ਿਆਦਾ ਬਦਲਾਅ ਆਇਆ ਹੈਗਾ ਸਾਡੇ ਪੁਰਾਣੇ ਸਮੇਂ ਵਿੱਚ ਇੰਨੀ ਜ਼ਿਆਦਾ ਟੈਕਨੋਲੋਜੀ ਨਹੀਂ ਸੀ ਔਰ ਸਾਡੇ ਮਨੋਰੰਜਨ ਲਈ ਕਾਫੀ ਜ਼ਿਆਦਾ ਹੱਦ ਤੱਕ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਨਾਚ ਗੀਤ ਔਰ ਨਾਟਕ ਕਾਫੀ ਰਮਾਇਣ ਵਗੈਰਾ ਸਭ ਹਰ ਇੱਕ ਚੀਜ਼ ਉਪਲਬਧ ਕੀਤੀ ਗਈ ਸੀ ਪਰ ਜਿਵੇਂ ਜਿਵੇਂ ਸਾਡੇ ਟੈਕਨੋਲਜੀ ਆਉਂਦੀ ਗਈ ਉਸੇ ਤਰ੍ਹਾਂ ਸਾਡੇ ਉਸੇ ਤਰ੍ਹਾਂ ਸਾਡੇ ਮਨੋਰੰਜਨ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਗਿਆ ਔਰ ਸਾਡੇ ਟੈਕਨੋਲਜੀ ਕਾਰਨ ਸਾਡੇ ਮਨੋਰੰਜਨ ਵਿੱਚ ਕਾਫੀ ਸੁਧਾਰ ਹੋਇਆ ਔਰ ਸਾਡੇ ਆਪਸ ਵਿੱਚ ਬਹਿਣ ਖਲੋਣ ਦਾ ਵੀ ਕਾਫੀ ਘੱਟ ਹੋ ਗਿਆ ਆਪਸ ਵਿੱਚ ਜਿਸ ਕਾਰਨ ਸਾਨੂੰ ਆਪਸ ਵਿੱਚ ਮਿਲਣ ਲਈ ਵੀ ਕਾਫੀ ਤੰਗੀ ਹੋਈ ਔਰ ਸਾਰੇ ਆਪਣੇ ਮਨੋਰੰਜਨ ਲਈ ਔਨਲਾਈਨ ਹੀ ਟੈਕਨੋਲੋਜੀ ਔਨਲਾਈਨ ਹੀ ਟੈਕਨੋਲੋਜੀ 'ਤੇ ਮੋਬਾਇਲ ਫੋਨ 'ਤੇ ਟੀ ਵੀ 'ਤੇ ਸਭ ਕੁਛ ਆਪਣਾ ਮਨੋਰੰਜਨ ਕਰ ਲੈਂਦੇ ਹਨ ਪਰ ਜਿਵੇਂ ਪਹਿਲੇ ਪਹਿਲੇ ਹੁੰਦਾ ਸੀ ਕਿ ਸਭੀ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਬੈਠ ਕੇ ਮਨੋਰੰਜਨ ਕਰਦੇ ਸਨ ਉਸ ਤਰ੍ਹਾਂ ਉਸ ਤਰ੍ਹਾਂ ਆਪਸ ਵਿੱਚ ਪਿਆਰ ਵੱਧਦਾ ਸੀ ਪਰ ਹੁਣ ਨਹੀਂ ਹੁਣ ਮੋਬਾਇਲ ਫੋਨ ਤੋਂ ਵੀ ਝਗੜੇ ਹੁੰਦੇ ਹਨ ਔਰ ਔਰ ਨੈੱਟਵਰਕ ਚੋਂ ਵੀ ਕਾਫੀ ਪ੍ਰੋਬਲਮ ਹੋ ਰਹੀ ਹੈ ਪਸ਼ੂ ਪਕਛੀਆਂ ਨੂੰ ਇਸ ਲਈ ਸਾਨੂੰ ਪੁਰਾਣੇ ਪੁਰਾਣੇ ਸਮੇਂ ਵਿੱਚ ਆਪਣਾ ਮਨੋਰੰਜਨ ਕਰਨ ਦੀ ਕਾਫੀ ਕਾਫੀ ਵਧੀਆ ਤਰੀਕੇ ਨਾਲ ਹੁੰਦਾ ਸੀ ਧੰਨਵਾਦ